ਮੈਂ ਵੀ ਇੱਕ ਡਾਂਸ ਮੁਕਾਬਲੇ ਵਿੱਚ ਭਾਗ ਲਿਆ ਸੀ ਜੋ ਕਿ ਮੇਰੇ ਲਈ ਬਹੁਤ ਹੀ ਖੁਸ਼ੀ ਅਤੇ ਸਫਲਤਾਪੂਰਵਕ ਰਿਹਾ ਮੈਂ ਡਾ ਡਾਂਸ ਕਰਨ ਵਾਲੇ ਵਿਅਕਤੀਆਂ ਨੂੰ ਉਹਨਾਂ ਦੇ ਸਰੀਰ ਵਿੱਚ ਕਾਫ਼ੀ ਜ਼ਿਆਦਾ ਤਾਕਤ ਮਿਲਦੀ ਹੈ ਜਿਹੜੇ ਕਿ ਡਾਂਸ ਕਰਦੇ ਹਨ ਡਾਂਸ ਵਿੱਚ ਬਹੁਤ ਹੀ ਇਤਿਹਾਸਿਕ ਡਾਂਸ ਹਨ ਜਿੱਦਾਂ ਕਿ ਕਿੱਕਲੀ ਗਿੱਧਾ ਭੰਗੜਾ ਲੁੱਡੀ ਗਿੱਧ ਹਿਮਾਚਲੀ ਡਾਂਸ ਫੋਕ ਡਾਂਸ ਪੰਜਾਬੀ ਡਾਂਸ ਬੜੇ ਹੀ ਡਾਂਸ ਹਨ ਜੋ ਕਿ ਆਪਣੇ ਭਾਰਤ ਵਿੱਚ ਬਹੁਤ ਹੀ ਮਸ਼ਹੂਰ ਹਨ ਕਿੱਕਲੀ ਪੰਜਾਬੀ ਕੁੜੀਆਂ ਦੀ ਲੋਕ ਖੇਡ ਵੀ ਹੈ ਅਤੇ ਲੋਕ ਨਾਚ ਵੀ ਹੈ ਰੋਡ ਰੋਡੇ ਖੇਡੀ ਦੀਆਂ ਨਿੱਕੇ ਵੀਰਾਂ ਭੈਣਾਂ ਨੂੰ ਖਿਡਾਉਂਦੀਆਂ ਅਤੇ ਗੁੱਡੇ ਗੁੱਡੀਆਂ ਦੇ ਕਾਜ ਰਚਾਉਂਦੀਆਂ ਹੋਈਆਂ ਕੁੜੀਆਂ ਦਾ ਮਨ ਜਦੋਂ ਹੁਲਾਰਾ ਖਾ ਕੇ ਮਸਤੀ ਦੇ ਵੇਗ ਵਿੱਚ ਆਉਂਦਾ ਹੈ ਤਾਂ ਉਹ ਜੱਟੋ ਬਣਾ ਕੇ ਜੁੱਟ ਦੇ ਬਣਾ ਕੇ ਇੱਕ ਦੂਜੇ ਦੇ ਹੱਥ ਨੂੰ ਕੀ ਕੀ ਕੰਘੀਆਂ ਪਾ ਕੇ ਘੁੰਮਣ ਲੱਗ ਜਾਂਦੀਆਂ ਹਨ ਕਿਉਂਕਿ ਬੱਚਿਆਂ ਨੂੰ ਹੂਟੇ ਲੈਣ ਵਿੱਚ ਖ਼ਾਸ ਆਨੰਦ ਆਉਂਦਾ ਹੈ ਜਿਸ ਕਰਕੇ ਉਹ ਲਾਟੂ ਚਲਾਉਂਦੇ ਭੰਬੀਰੀਆਂ ਘੁੰਮਾਉਂਦੇ ਚੱਕਰ ਚੜਾਉਂਦੇ ਅਤੇ ਉੜੋਲੇ ਝੂ ਝੂਟਦੇ ਹਨ ਗੇੜ ਦੀ ਰਫ਼ਤਾਰ ਨਾਲ ਉਹ ਕਿੱਕਲੀ ਦੇ ਗੀਤ ਵੀ ਗਾਉਂਦੇ ਹਨ ਕਿੱਕਲੀ ਕਲੀਰ ਦੀ ਕਿੱਕ ਲਿਕ ਕਲੀਰ ਦੀ ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇ ਭਰਜਾਈ ਦਾ ਫਿੱਟੇ ਮੂੰਹ ਜਵਾਈ ਦਾ ਗਈ ਸਾਂ ਮੈਂ ਰੰਗਾ ਗੰਗਾ ਗਈ ਸਾਂ ਮੈਂ ਗੰਗਾ ਚੜ੍ਹਾ ਲਈਆਂ ਵੰਗਾਂ ਅਸਮਾਨੀ ਮੇਰਾ ਘੱਗਰਾ ਮੈਂ ਕਿਹੜੀ ਕਿੱਕਲੀ ਟੰਗਾ ਨੀ ਮੈਂ ਇਸੇ ਕਿੱਕਲੀ ਟੰਗਾ ਨੀ ਮੈਂ ਐਸੀ ਕਿੱਕ ਉਸ ਕਿੱਕਲੀ ਟੰਗਾ ਇਹ ਹੈ ਪ ਲੋਕ ਗੀਤ ਦਾ ਕਿੱਕਲੀ ਜੋ ਕਿ ਪੰਜਾਬੀਆਂ ਵਿੱਚ ਬੱਚੀਆਂ ਛੋਟੀਆਂ ਹੁੰਦੀਆਂ ਗਾਉਂਦੀਆਂ ਹੁੰਦੀਆਂ ਸਨ